ਅੱਜ ਕੱਲ੍ਹ ਜਨਮ ਦਿਨ ਮਨਾਉਣਾ ਬਹੁਤ ਵਧੀਆ ਮੰਨਿਆਂ ਜਾਂਦਾ ਏ ਕਿਉਂਕਿ ਸਾਲ ਦੇ ਵਿੱਚ ਇੱਕ ਵਾਰ ਜਨਮ ਦਿਨ ਆਉਂਦਾ ਏ ਅਤੇ ਉਹਦੇ ਕਰਕੇ ਉਹ ਸਾਰੇ ਲੋਕ ਆਪਣਾ ਕਿਹੜੇ ਡੇ ਹੁੰਦਾ ਮੈਂਮੋਰੇਬਲ ਰੱਖਦੇ ਆ ਅਤੇ ਜ਼ਿਆਦਾਤਰ ਮੈਂ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾਉਣਾ ਹੁੰਦਾ ਤਾ ਪਰ ਮੇਨ ਆਹ ਏ ਕਿ ਸਵੇਰੇ ਪਹਿਲਾਂ ਸਾਰੇ ਲੋਕ ਜਲਦੀ ਉੱਠਦੇ ਆ ਅਤੇ ਉੱਠ ਕੇ ਪਹਿਲਾਂ ਹਿਸਟੋਰੀਕਲ ਪਲੇਸ 'ਤੇ ਵਿਜਿਟ ਕਰਦੇ ਕਿਵੇਂ ਜਿਵੇਂ ਕਿ ਪੰਜਾਬ ਦੇ ਲੋਕ ਜ਼ਿਆਦਾਤਰ ਸਵੇਰੇ ਸਿੱਖ ਟੈਂਪਲ ਜਾਂਦੇ ਆ ਅਤੇ ਉਹ ਉੱਥੇ ਹੈਗੇ ਮੱਥਾ ਉੱਥੇ ਟੇਕਦੇ ਆ ਜਿਹਦੇ ਕਰਕੇ ਇਹਨਾਂ ਦਾ ਵਧੀਆ ਰਹੇ ਅਤੇ ਉਸ ਤੋਂ ਬਾਅਦ ਜੋ ਸਾਰੇ ਲੋਕ ਖਾਣ ਪੀਣ ਪਹੁੰਚ ਜਾਂਦੇ ਆ ਅਤੇ ਉੱਥੇ ਕੇਕ ਵੀ ਕੱਟਦੇ ਆ ਅਤੇ ਅਲੱਗ ਅਲੱਗ ਤਰੀਕੇ ਦੀਆਂ ਫੋਟੋਆਂ ਖਿੱਚਦੇ ਆ ਪਕਵਾਨ ਪਕਵਾਨ ਖਾ ਕੇ ਅਤੇ ਇਹਦੇ ਕਰਕੇ ਉਹ ਆਪਣਾ ਡੇ ਕਿਹੜਾ ਹੁੰਦਾ ਉਹਨਾਂ ਦਾ ਵਧੀਆ ਰਹਿੰਦਾ ਅਤੇ ਉਹ ਡੇ ਹੁੰਦਾ ਉਹਨਾਂ ਦਾ ਮੈਬਰਏਬਲ ਬਣਦਾ ਅਤੇ ਸ਼ਾਮ ਦੇ ਵੇਲੇ ਉਹ ਸਾਰੇ ਲ ਜਾਣੇ ਇਕੱਠੇ ਹੋ ਕੇ ਫੋਟੋਆਂ ਖਿੱਚਦੇ ਆ